ਪਹਿਲੇ ਪਹਿਲੇ ਲੋਕ ਨਿੱਕੀ ਨਿੱਕੀ ਚੀਜ਼ ਨੂੰ ਕਾਪੀਆਂ ਉੱਤੇ ਲਿਖਦੇ ਸਨ ਪਰ ਅੱਜ ਦੇ ਦੌਰ 'ਤੇ ਸਭ ਕੁਝ ਇੰਟਰਨੈੱਟ ਔਨਲਾਈਨ ਜਾਂ ਫਲੈਕਸ ਦੀ ਵਰਤੋਂ ਕੀਤੀ ਜਾਂਦੀ ਹੈ ਅੱਜ ਕੱਲ੍ਹ ਲੋਕ ਬੁੱਕਾਂ ਵਿੱਚ ਜਾਂ ਕਿਤਾਬਾਂ ਜਾਂ ਪਰਚੀਆਂ ਉੱਤੇ ਲਿਖਣਾ ਪਸੰਦ ਨਹੀਂ ਕਰਦੇ ਅੱਜ ਕੱਲ੍ਹ ਨਵੇਂ ਜਿਵੇਂ ਕਿ ਕੰਪਿਊਟਰ ਔਨਲਾਈਨ ਸਿਸਟਮ ਲੋਕ ਬੱਚੇ ਅੱਜ ਕੱਲ੍ਹ ਬੁੱਕਾਂ ਵਿੱਚ ਹਿਸਾਬ ਕਿਤਾਬ ਕਰਨਾ ਨਹੀਂ ਪਸੰਦ ਕਰਦੇ ਅੱਜ ਕੱਲ੍ਹ ਸਮੇਂ ਦੀ ਬਚਾਵ ਕਰਨਾ ਬਹੁਤ ਜ਼ਰੂਰੀ ਹੋ ਗਿਆ ਹੈ ਲੋਕ ਅੱਜ ਦੇ ਸਮੇਂ ਵਿੱਚ ਇੰਟਰਨੈੱਟ ਔਨਲਾਈਨ ਚੀਜ਼ਾਂ ਦਾ ਵੈਬਸਾਈਟਾਂ ਦਾ ਯੂਜ ਵਰਤੋਂ ਕੀਤੀ ਜਾਂਦੀ ਹੈ ਪਿਛਲੇ ਕੁਛ ਸਮਿਆਂ ਵਿੱਚ ਪਿੱਛਲੇ ਪੁਰਾਣੇ ਸਮਿਆਂ ਵਿੱਚ ਓਫ਼ਿਸ ਦਫਤਰਾਂ ਜਾਂ ਸਟੇਸ਼ਨਾਂ 'ਤੇ ਹਰ ਪਾਸੇ ਬੁੱਕਾਂ ਦੀ ਵਰਤੋਂ ਕੀਤੀ ਜਾਂਦੀ ਸੀ ਬੁੱਕਾਂ ਵਿੱਚ ਤਰ੍ਹਾਂ ਤਰ੍ਹਾਂ ਦੇ ਨੋਟ ਬਣਾਏ ਜਾਂਦੇ ਸਨ ਜਦ ਕਿ ਅੱਜ ਦੇ ਸਮੇਂ ਵਿੱਚ ਕੰਪਿਊਟਰ ਔਨਲਾਈਨ ਸਿਸਟਮ ਉਪਲਬਧ ਹੋ ਗਿਆ ਹੈ ਜਿਸ ਨਾਲ਼ ਸਾਡੇ ਸਮੇਂ ਦੀ ਵੀ ਬੱਚਤ ਹੋਣੀ ਸ਼ੁਰੂ ਹੋ ਗਈ ਹੈ ਅਤੇ ਨਵੀਂ ਟੈਕਨੋਲਜੀ ਦਾ ਵੀ ਪਤਾ ਲੱਗਣਾ ਸ਼ੁਰੂ ਹੋ ਗਿਆ ਹੈ ਅੱਜ ਕੱਲ੍ਹ ਲੋਕ ਕੰਪਿਊਟਰ ਇੰਟਰਨੈੱਟ ਦੀ ਵਰਤੋਂ ਦੇ ਨਾਲ਼ ਬਹੁਤ ਸਪੀਡ ਨਾਲ਼ ਸਾਰੇ ਕੰਮ ਕਰ ਲੈਂਦੇ ਹਨ ਪਿਛਲੇ ਸਮੇਂ ਵਿੱਚ ਲੈਂਡਲਾਈਨ ਫੋਨਾਂ ਦੀ ਵੀ ਵਰਤੋਂ ਬਹੁਤ ਜ਼ਿਆਦਾ ਹੁੰਦੀ ਸੀ ਜਦ ਕਿ ਅੱਜ ਕੱਲ੍ਹ ਸੈੱਲ ਫੋਨਾਂ ਨੂੰ ਜ਼ਿਆਦਾ ਮੰਨਿਆ ਜਾਂਦਾ ਹੈ ਇੱਕ ਬੰਦਾ ਦੂਸਰੇ ਬੰਦੇ ਨੂੰ ਔਨਲਾਈਨ ਚੈਟਿੰਗ ਕਰ ਸਕਦਾ ਹੈ ਉਹ ਇੱਕ ਬੰਦੇ ਨੂੰ ਦੂਸਰੇ ਬੰਦੇ ਦੀ ਜਗ੍ਹਾ 'ਤੇ ਬੈਠ ਕੇ ਇੱਕ ਦੂਜੇ ਨੂੰ ਦੇਖ ਸਕਦੇ ਹਨ ਆਮੋ ਸਾਹਮਣੇ ਬੈਠ ਕੇ ਗੱਲਾਂ ਕਰ ਸਕਦੇ ਹਨ ਅੱਜ ਕੱਲ੍ਹ ਲੋਕ ਦਫ਼ਤਰਾਂ ਵਿੱਚ ਆਪਣੇ ਦੋ ਘੰਟੇ ਦੇ ਕੰਮ ਨੂੰ ਇਹ ਅੱਧੇ ਘੰਟੇ ਵਿੱਚ ਕੰਪਿਊਟਰ ਦੇ ਹਿਸਾਬ ਨਾਲ਼ ਖਤਮ ਕਰ ਲੈਂਦੇ ਹਨ ਕੁਝ ਲੋਕ ਅੱਜ ਵੀ ਪੁਰਾਣੇ ਤਰੀਕੇ ਨਾਲ਼ ਬੁੱਕਾਂ ਦੇ ਵਿੱਚ ਕਿਤਾਬਾਂ ਵਿੱਚ ਸਾਰੇ ਆਪਣੇ ਦਫ਼ਤਰ ਦੇ ਕੰਮ ਲਿਖਦੇ ਹਨ ਜਦ ਕਿ ਅੱਜ ਔਨਲਾਈਨ ਸਿਸਟਮ ਆ ਗਿਆ ਹੈ ਜਿਸ ਕਰਕੇ ਸਭ ਤੋਂ ਜ਼ਿਆਦਾ ਵਰਤੋਂ ਕੰਪਿਊਟਰ ਦੀ ਕੀਤੀ ਜਾਂਦੀ ਹੈ ਕੁਝ ਲੋਕ ਪੁਰਾਣੇ ਸਮੇਂ ਵਿੱਚ ਕੈਮਰੇ ਦਾ ਘਰ ਹੀ ਵਰਤੋਂ ਕੀਤੀ ਜਾਂਦੀ ਸੀ ਜਦ ਕਿ ਅੱਜ ਕੱਲ੍ਹ ਫੋਨ ਵਿੱਚ ਹੀ ਫੋਟੋਸ ਖਿੱਚ ਲੈਂਦਾ ਹੈ ਬੰਦਾ ਆਪਣੇ ਫੋਨ ਵਿੱਚ ਸਭ ਕੁਛ ਤਸਵੀਰਾਂ ਲੈ ਸਕਦਾ ਹੈ ਅਤੇ ਵੀਡੀਓ ਬਣਾ ਸਕਦਾ ਹੈ ਸਾਨੂੰ ਬਾਹਰ ਦੇ ਕੈਮਰੇ ਵਾਲਿਆਂ ਦੀ ਲੋੜ ਨਹੀਂ ਪੈਂਦੀ ਕੁਝ ਲੋਕ ਪਹਿਲਾਂ ਕੈਸਟਾਂ ਦੀ ਵਰਤੋਂ ਕਰਦੇ ਸਨ ਜਦ ਕਿ ਅੱਜ ਦੇ ਸਮੇਂ ਵਿੱਚ ਪੈਂਡਰਾਈਵ ਚਿੱਪ ਆਦਿ ਆ ਗਏ ਹਨ ਪਿਛਲੇ ਸਮੇਂ ਦੇ ਮੁਕਾਬਲੇ ਅੱਜ ਦੇ ਸਮੇਂ ਵਿੱਚ ਬਹੁਤ ਤਕਨੌਲੋਜੀ ਵੱਧ ਗਈ ਹੈ ਜਿਸ ਨਾਲ਼ ਲੋਕਾਂ ਨੂੰ ਬਹੁਤ ਸਹੂਲਤਾਂ ਪ੍ਰਾਪਤ ਹੋ ਰਹੀਆਂ ਹਨ ਫੋਨ ਟੈਕਨੋਲਜੀ ਨਵੇਂ ਤਰੀਕੇ ਦੇ ਇਸ਼ਤਿਹਾਰ ਆਪਾਂ ਹਰ ਚੀਜ਼ ਕੰਪਿਊਟਰ 'ਤੇ ਬਣਾ ਸਕਦੇ ਹਨ